ਅਸੀਂ ਜਦੋਂ ਘੁੰਮਣ ਜਾਈਦਾ ਹੈ ਤਾਂ ਸਾਨੂੰ ਇਹੀ ਚਾਅ ਹੁੰਦਾ ਹੈ ਕਿ ਅਸੀਂ ਹੋਟਲਾਂ ਅਤੇ ਢਾਬਿਆਂ 'ਚ ਕੁਝ ਖਾਈਏ ਉਹਨਾਂ ਦਾ ਸਵਾਦ ਕੁਛ ਵੱਖਰਾ ਹੀ ਹੁੰਦਾ ਕਿ ਉਹਨਾਂ ਦੀਆਂ ਚੀਜ਼ਾਂ ਇੰਨੀਆਂ ਸਵਾਦ ਹੁੰਦੀਆਂ ਹੈ ਕਿ ਬੰਦਾ ਉਸ ਚੀਜ਼ ਨੂੰ ਭੁੱਲ ਨਹੀਂ ਸਕਦਾ ਹੋਟਲਾਂ ਵਿੱਚ ਤਾਂ ਕਾਫੀ ਕੁਛ ਮਿਲ ਜਾਂਦਾ ਬਟ ਜੋ ਸਵਾਦ ਢਾਬਿਆਂ ਦਾ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦਾ ਹੋਟਲਾਂ ਵਿੱਚ ਤੁਸੀਂ ਖਾ ਸਕਦੇ ਹੋ ਜਿਵੇਂ ਕਿ ਚਾਈਨੀਜ਼ ਖਾਣਾ ਖਾ ਸਕਦੇ ਹੋ ਬਟ ਢਾਬਿਆਂ ਦੀ ਸਰਸੋਂ ਦਾ ਸਾਗ ਅਤੇ ਰੋਟੀ ਮੱਕੀ ਦਾ ਟੋਡਾ ਕਿੱਥੇ ਨਹੀਂ ਮਿਲਦਾ ਅਤੇ ਢਾਬਿਆਂ 'ਤੇ ਸਾਨੂੰ ਮੈਨੂੰ ਪਨੀਰ ਖਾਣਾ ਬੜਾ ਪਸੰਦ ਹੈ ਕਿਉਂਕਿ ਉਸ 'ਚ ਪ੍ਰੋਟੀਨ ਹੁੰਦਾ ਅਤੇ ਉਹ ਮੇਰਾ ਹੈ ਵੀ ਫੇਵਰੇਟ ਅਤੇ ਮੈਂ ਉਸ ਨੂੰ ਖਾ ਕੇ ਬਹੁਤ ਖੁਸ਼ ਹੁੰਦੀ ਹਾਂ ਅਤੇ ਉਸ ਦੀ ਰੋਟੀ ਢਾਬਿਆਂ ਦੀ ਰੋਟੀ ਵੀ ਬੜੀ ਸਵਾਦ ਹੁੰਦੀ ਹੈ ਹੋਟਲਾਂ ਦੀ ਵੀ ਰੋਟੀ ਸਵਾਦ ਹੁੰਦੀ ਹੈ ਬਟ ਜੋ ਸਵਾਦ ਢਾਬਿਆਂ ਦਾ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦਾ ਸਾਨੂੰ ਸਾਰਿਆਂ ਨੂੰ ਢਾਬਿਆਂ ਦੀ ਹੀ ਰੋਟੀ ਖਾਣੀ ਚਾਹੀਦੀ ਹੈ ਅਤੇ ਉਸ ਦਾ ਮੱਕੀ ਦਾ ਟੋਡਾ ਅਤੇ ਸਰਸੋਂ ਦਾ ਸਾਗ ਖਾ ਕੇ ਮਜ਼ਾ ਹੀ ਆ ਜਾਂਦਾ ਜੋ ਕਿ ਸਾਡਾ ਪੰਜਾਬ ਜਿਹਨੂੰ ਰੀਪ੍ਰਜੈਂਟ ਕਰਦਾ ਉਹ ਹੈ ਮੱਕੀ ਦਾ ਟੋਡਾ ਅਤੇ ਸਰਸੋਂ ਦਾ ਸਾਗ ਉਹ ਪੰਜਾਬ ਦੀ ਸਭ ਤੋਂ ਫੇਵਰੇਟ ਅਤੇ ਵਧੀਆ ਅਤੇ ਪ੍ਰਸਿੱਧ ਡਿਸ਼ ਹੈ ਜੋ ਸਾਰੇ ਲੋਕ ਬਾਹਰੋਂ ਆ ਕੇ ਵੀ ਇੱਥੇ ਇੰਡੀਆ 'ਚ ਢਾਬਿਆਂ ਦਾ ਹੀ ਖਾਣਾ ਪਸੰਦ ਕਰਦੇ ਆ